ਮੈਂ ਆਪਣੇ ਘਰ ਦੀ ਬਾਗਬਾਨੀ ਦੇ ਵਿੱਚ ਵੱਖ ਵੱਖ ਕਿਸਮ ਦੇ ਪੌਦੇ ਅਤੇ ਵੇਲਾਂ ਉਗਾਈਆਂ ਹੋਈਆਂ ਹਨ ਇਹ ਮੇਰੇ ਘਰ ਦੀ ਬਾਗਬਾਨੀ ਦੇ ਵਿੱਚ ਇਹ ਵੱਖ ਵੱਖ ਕਿਸਮ ਦੇ ਫੁੱਲਾਂ ਦੇ ਪੌਦੇ ਹਨ ਜੋ ਬਹੁਤ ਹੀ ਖੂਬਸੂਰਤ ਲੱਗਦੇ ਹਨ ਅਤੇ ਸਾਡੇ ਘਰ ਦੀ ਸੁੰਦਰਤਾ ਨੂੰ ਹੋਰ ਜ਼ਿਆਦਾ ਵਧਾਉਂਦੇ ਹਨ ਮੈਂ ਰੋਜ਼ਾਨਾ ਇਹਨਾਂ ਪੌਦਿਆਂ ਦੇ ਵਿੱਚ ਵੇਲਾਂ ਦੇ ਵਿੱਚ ਪਾਣੀ ਪਾਉਂਦੀ ਹਾਂ ਅਤੇ ਕਿਸੇ ਵੀ ਕਿਸਮ ਦਾ ਕੈਮੀਕਲ ਨਹੀਂ ਯੂਸ ਕਰਦੀ ਮੈਂ ਜਦੋਂ ਵੀ ਇਹਨਾਂ ਪੌਦਿਆਂ ਨੂੰ ਵੱਡੇ ਹੁੰਦੇ ਹੋਏ ਦੇਖਦੀ ਹਾਂ ਤਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਮੈਂ ਇਹਨਾਂ ਦੀ ਬਹੁਤ ਦੇਖਭਾਲ ਕਰਦੀ ਹਾਂ ਅਤੇ ਮੈਨੂੰ ਬਹੁਤ ਹਰਿਆਲੀ ਬਹੁਤ ਜ਼ਿਆਦਾ ਪਸੰਦ ਹੈ ਮੈਂ ਆਪਣੀ ਬਾਗਬਾਨੀ ਦੇ ਵਿੱਚ ਅਮਰਵੇਲ ਅਤੇ ਹੋਰ ਅਲੱਗ ਅਲੱਗ ਕਿਸਮ ਦੀਆਂ ਵੇਲਾਂ ਉਗਾਈਆਂ ਹੋਈਆਂ ਹਨ ਜੋ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਹਨ ਅਤੇ ਮੈਂ ਜਦੋਂ ਵੀ ਜਾਂਦੀ ਹਾਂ ਤਾਂ ਮੈਨੂੰ ਸਕੂਨ ਮਿਲਦਾ ਹੈ ਉੱਥੇ ਜਾ ਕੇ ਜੋ ਪੌਦੇ ਹਨ ਆਪਾਂ ਨੂੰ ਬਹੁਤ ਕੁਝ ਦਿੰਦੇ ਹਨ ਜਿਸ ਤਰ੍ਹਾਂ ਫਲ ਸਬਜ਼ੀਆਂ ਔਕਸੀਜਨ ਦਿੰਦੇ ਹਨ ਸ਼ਾਂਤ ਕਰਦੇ ਹਨ ਆਪਾਂ ਨੂੰ